ਸਭ ਤੋਂ ਮਸ਼ੂਰ ਭੰਗੜੇ ਦੇ ਗੀਤ ਬਹੁਤ ਸਾਰੇ ਨੇ ਜਿਹੜੇ ਪੰਜਾਬ ਦੇ ਲੋਕ ਉਹਨੂੰ ਬਹੁਤ ਪਸੰਦ ਕਰਦੇ ਨੇ ਜਿਵੇਂ ਕੀ ਬੱਬੂ ਮਾਨ ਦਾ ਗਾਨਾ ਸੌਨ ਦੀ ਝੜੀ ਤੇ ਸੌਨ ਦੀ ਝੜੀ ਇਸ ਗਾਨੇ ਉੱਤੇ ਹਰ ਸਕੂਲ ਅਤੇ ਹਰ ਕੋਲੇਜ ਵਿੱਚ ਬੱਚੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਤੇ ਇਹਦੇ ਉੱਤੇ ਭੰਗੜਾ ਪਾ ਕੇ ਦਿਖਾਂਦੇ ਹਨ ਇਸ ਤੋਂ ਅਲਾਵਾ ਹਰਭਜਨ ਮਾਨ ਦਾ ਗਾਨਾ ਮੈਂ ਵਾਰੀ ਤੇ ਸੰਮੀ ਮੇਰੀ ਵਾਰ ਇਹ ਗਾਨਾ ਵੀ ਬੱਚੇ ਬਹੁਤ ਪਸੰਦ ਕਰਦੇ ਹਨ ਹਰਭਜਨ ਮਾਨ ਤੇ ਬੱਬੂ ਮਾਨ ਦੇ ਜਿੰਨੇ ਵੀ ਲੋਕ ਪ੍ਰਿਯ ਗੀਤ ਨੇ ਉਹ ਸਾਰੇ ਬੱਚਿਆਂ ਨੂੰ ਬਹੁਤ ਪਸੰਦ ਆਂਦੇ ਹਨ ਤੇ ਉਹਦੇ ਉੱਤੇ ਉਹ ਭੰਗੜਾ ਪਾਣਾ ਪਸੰਦ ਕਰਦੇ ਹਨ ਅੱਜ ਦੇ ਜਮਾਨੇ ਵਿੱਚ ਜਿਹੜਾ ਸਭ ਤੋਂ ਕਾਮਯਾਬ ਪੰਜਾਬੀ ਸਿੰਗਰ ਹੈ ਉਹ ਹੈ ਦਲਜੀਤ ਦੋਸਾਂਝ ਤੇ ਉਹਦੇ ਵੀ ਗਾਨੇ ਭੰਗੜੇ ਵਾਸਤੇ ਲੋ ਲੋਕ ਤੇ ਬੱਚੇ ਬਹੁਤ ਪਸੰਦ ਕਰਦੇ ਹਨ ਤੇ ਉਨ੍ਹਾਂ ਦੇ ਗਾਨਿਆਂ ਉੱਤੇ ਵਧੀਆ ਤਰੀਕੇ ਨਾਲ ਭੰਗੜੇ ਨੂੰ ਪੇਸ਼ ਕਰਦੇ ਹਨ ਅੱਜ ਵੀ ਹੋਰ ਵੀ